ਸਾਡੇ ਦੇਸ਼ ਦੇ ਦੱਖਣ ਦੇ ਦਿਸ਼ਾ ਦੇ ਵੱਲ ਬਹੁਤ ਸਾਰੇ ਮਛੇਰੇ ਰਹਿੰਦੇ ਹਨ ਮੱਛੀਆਂ ਫੜਨ ਵਾਲੇ ਅਤੇ ਇਹ ਇਹਨਾਂ ਦਾ ਮੱਛੀਆਂ ਫੜਨ ਦੇ ਨਾਲ ਹੀ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਇਹਨਾਂ ਦਾ ਇਹੀ ਕਾਰੋਬਾਰ ਹੈ ਅਤੇ ਮਛੇਰੇ ਤਿਉਹਾਰ ਇਸ ਤਰ੍ਹਾਂ ਮਨਾਉਂਦੇ ਆ ਕਿ ਇੱਕ ਜਗ੍ਹਾ ਅੱਗ ਬਾਲ ਕੇ ਹੈ ਨਾ ਮੱਛੀਆਂ ਨੂੰ ਪਕਾ ਕੇ ਅਲੱਗ ਅਲੱਗ ਤਰ੍ਹਾਂ ਦੀਆਂ ਹੈ ਨਾ ਚੀਜ਼ਾਂ ਬਣਾਉਂਦੇ ਆ ਅਤੇ ਇਸ ਤਰ੍ਹਾਂ ਇਹ ਤਿਉਹਾਰਾਂ ਨੂੰ ਮਨਾਉਂਦੇ